ਪੰਜ ਹਜ਼ਾਰ ਪੰਜ ਸੌ ਪਚਵੰਜਾ ਛੇ ਸੌ ਇੱਕ ਬਾਰਾਂ ਸੌ ਇੱਕ ਪੰਜ ਹਜ਼ਾਰ ਪੰਜ ਸੌ ਛਪੰਜਾ ਇੱਕ ਲੱਖ ਤਿੰਨ ਸੌ ਬਾਈ